ਸਾਡੇ ਧਾਰਮਿਕ ਗੁਰੂ ਜਿਹੜੇ ਸਾਡੇ ਦਸਵੇਂ ਪਾਤਸ਼ਾਹ ਬਾਬਾ ਨਾਨਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਰਾਮਦਾਸ ਜੀ ਅਤੇ ਅਸੀਂ ਉਹਨਾਂ ਤੋਂ ਆਗਿਆ ਲੈ ਕੇ ਚੱਲੀਏ ਤਾਂ ਸਾਡੇ ਵੀ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਕੁਛ ਦਿੱਤਾ ਅਤੇ ਬਹੁਤ ਸਾਨੂੰ ਚੰਗੇ ਗਿਆਨ ਧਿਆਨ ਦਿੱਤੇ ਅਤੇ ਬਹੁਤ ਹੀ ਅਸੀਂ ਇਸ ਗੁਰੂਆਂ ਤੋਂ ਸਿੱਖਿਆ ਲਈ ਸੱਚ ਹੱਕ ਖਾਣਾ ਅਤੇ ਕਿਰਤ ਕਮਾਈ ਕਰਨੀ ਅਤੇ ਦਸਵੇਂ ਪਾਤਸ਼ਾਹ ਗੁਰੂ ਮਹਾਰਾਜ ਦੀ ਆਗਿਆ ਲੈ ਕੇ ਅਤੇ ਦਸਵਾਂ ਕੱਢਣਾ ਲੰਗਰ ਲਗਾਉਣੇ ਠੰਡੇ ਪਾਣੀ ਦੀਆਂ ਸਿਲਾਂ ਲਗਾਉਣੀਆਂ ਅਤੇ ਇਹਨਾਂ ਤੋਂ ਅਸੀਂ ਬਹੁਤ ਕੁਛ ਸਿੱਖੇ ਹਾਂ ਅਤੇ ਇਹਨਾਂ ਦੀ ਆਗਿਆ ਲੈ ਕੇ ਇੱਥੋਂ ਤੱਕ ਅਸੀਂ ਪਹੁੰਚ ਸਕੇ ਹਾਂ ਅਤੇ ਬਹੁਤ ਹੀ ਕੁਛ ਦਿੱਤਾ ਸਾਨੂੰ ਅਤੇ ਬਹੁਤ ਹੀ ਕੁਛ ਇਹ ਗੁਰੂ ਮਹਾਰਾਜ ਧੰਨ ਗੁਰੂ ਮਹਾਰਾਜ ਮਹਾਰਾਜ ਨੇ ਸਾਨੂੰ ਸਿਖਾਇਆ ਅਤੇ ਉਹ ਹੀ ਆਗਿਆ ਲੈ ਕੇ ਚੱਲੇ ਹਾਂ ਨਾ ਕਿਸੇ ਦਾ ਪਰਮਾਤਮਾ ਨੇ ਆਖਿਆ ਮਾੜਾ ਕਰੋ ਅਤੇ ਵੰਡ ਕੇ ਛਕੋ ਅਤੇ ਚੰਗੇ ਚੰਗੇ ਕੰਮ ਕਰੋ ਕਿਰਤ ਕਮਾਈਆਂ ਕਰੋ ਸੱਚ ਹੱਕ ਦੀ ਕਰੋ ਦੱਬ ਕੇ ਬਹੁਤ ਰੱਜ ਕੇ ਖਾਓ ਸੱਚ 'ਤੇ ਅਤੇ ਸਚਿਆਈ 'ਤੇ ਸਾਨੂੰ ਪਰਮਾਤਮਾ ਨੇ ਆਖਿਆ ਅਤੇ ਸੱਚਾਈ 'ਤੇ ਹੀ ਮਹਾਰਾਜ ਸਾਨੂੰ ਬਖਸ਼ੀ ਰੱਖਣਗੇ ਅਤੇ ਅਸੀਂ ਉਹਨਾਂ ਦੇ ਹੁਕਮ ਮੰਨੀ ਜਾਵਾਂਗੇ ਅਤੇ ਪਰਮਾਤਮਾ ਨੇ ਸਾਨੂੰ ਬਹੁਤ ਕੁਛ ਸਿੱਖਣ ਨੂੰ ਦਿੱਤਾ ਅਤੇ ਉਹ ਅਸੀਂ ਉਹਨਾਂ ਤੋਂ ਬਾਹਰ ਨਹੀਂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਬਖਸ਼ਿਆ ਅਤੇ ਉਹਨਾਂ ਦੇ ਕਹਿਣੇ 'ਤੇ ਅਸੀਂ ਚੱਲਾਂਗੇ